ਠੀਕ ਹੈ ਠੀਕ ਹੈ ਵਧੀਆ ਬਾਈ ਤੂੰ ਦੱਸ ਕਿਵੇਂ ਆ

ਕੁਛ ਨਹੀਂ ਬਸ ਵਿਹਲੇ ਬਸ ਬਹੁਤ ਬੀਜੀ ਆ ਹੂੰ ਹਾਂ ਹਾਂ ਵਧੀਆ ਵਧੀਆ ਹੂੰ ਹਾਂ ਵਧੀਆ ਹਾਂ ਇੰਨਾ ਹੋ ਗਿਆ ਵਧੀਆ ਹੋ ਗਿਆ ਹੂੰ ਹੂੰ ਹੂੰ ਠੀਕ ਹੈ ਹਾਂ ਹਾਂ ਹਾਂ ਬਣਾ ਲਈ ਤੂੜੀ ਤਾੜੀ ਤਾਂ ਬਣਾ ਲਈ ਹੈਂ ਇਹ ਪੰਦਰਾਂ ਬਣਾ ਲਈਆਂ ਸੀ ਪੰਦਰਾਂ ਬਣਾ ਲਈਆਂ ਸੀ ਯਾਰ

ਨਾ ਭਰਾਵਾ ਵਿੱਚ ਹੀ ਵਾਹਤਾ ਸੀਗਾ ਅੱਗ ਉੱਗ ਨਹੀਂ ਲਗਾਈ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਇਹ ਤਾਂ ਹੈ ਨਾਲੇ ਇਹਦੇ ਵਿੱਚ ਜਿਹੜੇ ਮਤਲਬ ਕਿ ਨਾ ਆਪਾਂ ਬਾਲ ਦਿੰਦੇ ਹਾਂ ਜੀਵ ਜੰਤੂ ਹੁੰਦੇ ਜਿਹੜੇ ਵਿੱਚ ਮਤਲਬ ਇਹਦੇ ਫਸਲ ਹੁੰਦੀ ਆ ਇੱਕ ਤਰ੍ਹਾਂ ਦੀ ਆਪਣੀ ਰੇਹ ਹੁੰਦੀ ਆ ਇਹ ਵਿੱਚ ਉਹ ਨਹੀਂ ਕਰ ਰਹੇ ਸਗੋਂ ਫਸਲ ਵਧੀਆ ਹੁੰਦੀ ਇਹਨੂੰ ਤਾਂ ਵਿੱਚ ਹੀ ਵਾਉਣਾ ਚਾਹੀਦਾ ਇਹ ਸਾੜਨਾ ਨਹੀਂ ਚਾਹੀਦਾ ਇਸ ਚੀਜ਼ ਨੂੰ ਹੂੰ ਹਾਂ ਇਹਦੀ ਖਾਦ ਬਣ ਜਾਂਦੀ ਵਧੀਆ

ਹਾਂ ਹਾਂ ਝੋਨਾ ਲਗਾਵਾਂਗੇ ਹਾਂ ਹਾਂ ਤਿਆਰੀ ਆ ਹੂੰ ਹਾਂ ਬੀਜਤੀ ਪਨੀਰੀ ਹੂੰ ਗਿਆਰਾਂ ਇੱਕੀ ਹਾਂ ਉਹ ਵੀ ਵਧੀਆ ਹੁੰਦਾ ਬਾਸਮਤੀ ਹਾਂ ਹਾਂ ਹਾਂ ਗਿਆਰਾਂ ਇੱਕੀ ਅਤੇ ਆਪਣਾ ਜਿਹੜਾ ਬਸ ਇਹਦਾ ਅਠਾਰਾਂ ਦਾ ਵੀ ਵਧੀਆ ਝਾੜ ਊਂ ਤਾਂ ਇਹ ਵੀ ਹੁੰਦਾ ਹਾਂ ਹਾਂ ਹਾਂ ਨਹੀਂ ਬਾਰਾਂ ਵੀ ਲਗਾਊਂ ਮੈਂ ਥੋੜ੍ਹਾ ਜਿਹਾ ਐਂਤਕੀ ਉਹ ਵੀ ਲਗਾਵਾਂਗੇ ਹਾਂ ਪੰਜ ਚਾਰ ਕਿੱਲੇ ਉਹਦੇ ਲਗਾਵਾਂਗੇ ਠੀਕ ਹੈ ਕੁਛ ਦਸ ਬਾਰਾਂ ਕਿੱਲੇ ਦੂਈ ਦੇ ਦੱਬਦੇ ਹੂੰ ਹਾਂ ਹਾਂ ਨਹੀਂ ਨਹੀਂ ਉਹ ਦਾ ਵੀ ਝਾੜ ਵਧੀਆ ਹੈਗਾ ਚੰਗਾ ਸਮਾ ਕਿ ਹਾਂ ਹਾਂ ਵਧੀਆ ਪਾਣੀ ਠੀਕ ਹੈ ਹੂੰ ਬਾਕੀ ਨਹਿਰਾਂ ਦਾ ਪਾਣੀ ਹੁਣ ਬਾਕੀ ਸਾਡੇ ਉਹ ਲੱਗੇ ਵੀਆਂ ਸੋਲਰ ਮੋਟਰ ਲੱਗੀ ਹੋਈ ਆ ਹਾਂ ਹਾਂ ਉਹਦੇ 'ਚ ਚੱਲ ਚੱਲੀ ਜਾਂਦਾ ਦੂਜੀ ਮੋਟਰਾਂ ਵੀ ਲੱਗੀਆਂ ਹੋਈਆਂ ਵੀਆਂ ਕਿਉਂ ਇਹਦੇ ਵਿੱਚ ਚਲਦਾ ਹੀ ਰਹਿੰਦਾ ਮੱਕੀ ਬੀਜੀ ਆ ਹਾਂ ਚਾਰ ਕੁ ਕਿੱਲੇ ਬੀਜੀ ਆ ਮੱਕੀ ਅੱਛਾ ਮੂੰਗੀ ਨਹੀਂ ਨਹੀਂ ਵਧੀਆ ਵਧੀਆ ਹੋ ਜਾਂਦੀ ਹੈ ਜੇ ਨਾ ਕੋਈ ਮਾਰ ਪਵੇ ਤਾਂ ਮੂੰਗੀ ਤਾਂ ਵਧੀਆ ਹੀ ਕਈ ਵਾਰ ਨਾ ਜਿਵੇਂ ਮੀਂਹ ਮੂੰਹ ਜ਼ਿਆਦਾ ਪੈਂ ਜਾਂਦੇ ਯਾਰ ਉਹਦੇ ਗਲ ਗੁਲ ਜਾਂਦੀ ਜੇ ਪਾਣੀ ਪੂਣੀ ਜ਼ਿਆਦਾ ਖੜ ਜਾਵੇ ਮੌਸਮ ਦੇ ਜ਼ਿਆਦਾ ਦੇਰ ਉਹ ਰਹੇ ਨਾ

ਹੂੰ ਨਹੀਂ ਵਧੀਆ ਸਮਾ ਕਿ ਠੀਕ ਆ ਮੂੰਗੀ ਵੀ ਠੀਕ ਆ ਝਾੜ ਇਹਦਾ ਵੀ ਯਾਰ ਵਧੀਆ ਹੂੰ ਹੂੰ ਠੀਕ ਠੀਕ ਹੈ ਜੀ ਓਕੇ ਓਕੇ ਬਾਈ